ਭੰਗੜਾ ਐਰੋਬਿਕਸ ਆਪਣੇ ਪ੍ਰਤੀਭਾਗੀਆਂ ਵਿੱਚ ਰਚਨਾਤਮਾਂ ਨੂੰ ਮੇਰੇ ਹਿਸਾਬ ਨਾਲ਼ ਬੜਾ ਵਧੀਆ ਤਰੀਕੇ ਨਾਲ਼ ਪ੍ਰੇਰਿਤ ਕਰਦਾ ਹੈ ਜਿਵੇਂ ਕਿ ਭੰਗੜਾ ਇੱਕ ਕਿਸ ਐਰੋਬਿਕਸ ਇੱਕ ਕਿਸਮ ਦੀ ਐਕਸਰਸਾਈਜ਼ ਹੈ ਸਾਡੇ ਸਾਹਮਣੇ ਪਾਰਕ ਹੈ ਓਥੇ ਪਹਿਲੇ ਮੈਂ ਨਹੀਂ ਜਾਂਦੀ ਸੀ ਹੁਣ ਸ਼ੁਰੂ ਕੀਤਾ ਹੈ ਮੇਰੇ ਪਹਿਲੇ ਮੈਨੂੰ ਲੱਗਦਾ ਸੀ ਕਿ ਇਹ ਮੇਰੇ ਕੋਲ ਨਹੀਂ ਹੋਣਾ ਹੁਣ ਹੌਲੀ ਹੌਲੀ ਜਾਣ ਨਾਲ਼ ਮੈਂ ਐਕਸੈਸ ਕਰਨੀ ਸ਼ੁਰੂ ਕਰ ਤੀ ਓਥੇ ਬਹੁਤ ਜ਼ਿਆਦਾ ਲੋਕ ਵੀ ਆਉਂਦੇ ਹੈ ਬੱਚੇ ਜਵਾਨ ਬੁੱਢੇ ਸਭ ਕਰਦੇ ਨੇ ਹੁਣ ਮੇਰ ਪਹਿਲੇ ਮੈਨੂੰ ਖਾਂਸੀ ਵਗੈਰਾ ਵੀ ਆਉਂਦੀ ਸੀ ਸਾਹ ਸੂਹ ਚੜ੍ਹਦਾ ਸੀ ਹੁਣ ਸੈਰ ਕਰਨ ਨਾਲ਼ ਐਰੋ ਨਾਲ਼ ਮੈਨੂੰ ਥੋੜ੍ਹਾ ਫਰਕ ਪੈ ਗਿਆ ਹੈ ਭੰਗੜਾ ਐਰੋਬਿਕਸ ਇੱਕ ਕਿਸਮ ਦੀ ਐਕਸਸਾਈਜ਼ ਹੀ ਹੈ ਬਹੁਤ ਜ਼ਿਆਦਾ ਲੋਕ ਇਹ ਕਰਦੇ ਨੇ ਅਤੇ ਆਪਣੀ ਸਿਹਤ ਨੂੰ ਠੀਕ ਰੱਖਦੇ ਨੇ ਇਸ ਲਈ ਮੈਂ ਚਾਹੁੰਦੀ ਹਾਂ ਕਿ ਸਾਰੇ ਲੋਕ ਭੰਗੜਾ ਐਰੋਬਿਕਸ ਕਰਨ ਅਤੇ ਆਪਣੀ ਸਿਹਤ ਨੂੰ ਠੀਕ ਰੱਖਣ ਸਾਡੇ ਦੇਸ਼ ਵਿੱਚ ਇਹ ਭੰਗੜੇ ਐਰੋਬਿਕਸ ਨੂੰ ਕਾਫੀ ਪ੍ਰਾਥਿ ਪ੍ਰਾਥਮਿਕਤਾ ਦਿੱਤੀ ਗਈ ਹੈ ਜਿਵੇਂ ਕਿ ਲੋਕ ਭੰਗੜਾ ਐਰੋਬਿਕਸ ਕਰਦੇ ਨੇ ਅਤੇ ਆਪਣੀ ਸਿਹਤ ਨੂੰ ਠੀਕ ਰੱਖਦੇ ਨੇ ਬੱਚੇ ਬੁੱਢੇ ਸਾਰੇ ਕਰਦੇ ਨੇ ਸਾਰੇ ਕਰਨ ਅਤੇ ਆਪਣੀ ਸਿਹਤ ਨੂੰ ਠੀਕ ਰੱਖਣਗੇ ਇਸ ਲਈ ਮੈਂ ਲੋਕਾਂ ਨੂੰ ਇਹ ਪ੍ਰੇਰਨਾ ਦਿੰਦੀ ਹਾਂ ਕਿ ਇਹ ਕੰਮ ਕਰਨ